ਸਾਡੇ ਖੇਤਰ ਵਿੱਚ ਰਾਵੀ ਦੀਆ ਖੇਡਾਂ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਖੇਡੀਆਂ ਜਾਂਦੀਆਂ ਨੇ ਅਤੇ ਸਾਰੇ ਇਹ ਖੇਡਾਂ ਵਿੱਚ ਬਹੁਤ ਹੀ ਜ਼ਿਆਦਾ ਜਵਾਕ ਆਂਢ ਗੁਆਂਢ ਦੇ ਇਕੱਠੇ ਹੁੰਦੇ ਨੇ ਅਤੇ ਆਂਢ ਗੁਆਂਢ ਦੇ ਇਕੱਠੇ ਹੋ ਕੇ ਜਵਾਕ ਬਹੁਤ ਹੀ ਜ਼ਿਆਦਾ ਖੇਡਾ ਖੇਡੀਆਂ ਜਾਂਦੀਆਂ ਅਤੇ ਆਪਸ ਵਿੱਚ ਉਹਨਾਂ ਦਾ ਪਿਆਰ ਵੀ ਬਣਿਆ ਰਹਿੰਦਾ ਅਤੇ ਉਹਨਾਂ ਨੂੰ ਬੋਲਣ ਚਾਲਣ ਦਾ ਪਤਾ ਵੀ ਲੱਗ ਜਾਂਦਾ ਇਹ ਖੇਡਾ ਸਾਰੇ ਜਵਾਕ ਇਕੱਠੇ ਹੋ ਕੇ ਇਕ ਗਰਾਉਂਡ ਵਿਚ ਖੇਡਦੇ ਨੇ ਜਿਵੇਂ ਕਿ ਇਹ ਖੇਡਾਂ ਲੁਕਣ ਮੀਚੀ ਖੇਡਦੇ ਨੇ ਲੁਕਣ ਮੀਚੀ ਵਿਚ ਇੱਕ ਇੱਕ ਬੰਦੇ ਦੀ ਇੱਕ ਬੰਦੇ ਦਾਵੀ ਦਿੰਦਾ ਅਤੇ ਬਾਕੀ ਸਾਰੇ ਲੁਕਦੇ ਨੇ ਅਤੇ ਉਹ ਫਿਰ ਉਹਨਾਂ ਨੂੰ ਉਹ ਜਿਸਦੀ ਦਾਵੀ ਹੁੰਦੀ ਉਹ ਉਹਨਾਂ ਨੂੰ ਲੱਭਦਾ ਹੈਗਾ ਅਤੇ ਜਿਹੜਾ ਬੰਦਾ ਪਹਿਲ 'ਤੇ ਲੱਭਿਆ ਜਾਵੇ ਤਾਂ ਉਹਦੀ ਉਹਦੇ ਸਿਰ ਦਾਵੀ ਆ ਜਾਂਦੀ ਹੈ ਅਤੇ ਜੇ ਕੋਈ ਵੀ ਬੰਦਾ ਉਹਨੂੰ ਥੱਪਾ ਲਾ ਦਏ ਤਾਂ ਉਹਦੀ ਦੁਬਾਰਾ ਦਾਵੀ ਆ ਜਾਂਦੀ ਆ ਨਹੀਂ ਤਾਂ ਫਿਰ ਜਿਹੜਾ ਪਹਿਲ 'ਤੇ ਲੱਭੇ ਜਾਂਦਾ ਕਿ ਉਹਦੀ ਦਾਵੀ ਹੀ ਆਉਂਦੀ ਆ ਅਤੇ ਬਾਂਦਰ ਕਿਲਾ ਬਾਂਦਰ ਕਿਲਾ ਇੱਕ ਲੱਤ 'ਤੇ ਖੇਡਿਆ ਜਾਂਦਾ ਹੈਗਾ ਅਤੇ ਇਹ ਜੇ ਬਾਕੀ ਸਾਰੇ ਜਵਾਕ ਭੱਜਦੇ ਜਿਹਦੀ ਦਾਵੀ ਹੁੰਦੀ ਉਹ ਇੱਕ ਲੱਤ 'ਤੇ ਜਾ ਕੇ ਉਹਨੂੰ ਫੜਦਾ ਹੈਗਾ ਅਤੇ ਪਿੱਠੂ ਦੇ ਵਿੱਚ ਬਹੁਤ ਹੀ ਸਾਰੀਆਂ ਦਿਕਣੀਆਂ ਖੇਡੀਆਂ ਜਾਂਦੀਆਂ ਨੇ ਅਤੇ ਦਿਕਣੀਆਂ ਵਿੱਚ ਚਿਣੀਆਂ ਜਾਂਦੀਆਂ ਨੇ ਅਤੇ ਉਹ ਜਿਹੜਾ ਬੋਲ ਮਾਰ ਦਾ ਹੈਗਾ ਫਿਰ ਉਹਨਾਂ ਦੇ ਉਹ ਦੂਜੇ ਜਿਹੜੇ ਗਰੁੱਪ ਬਣੇ ਹੁੰਦੇ ਉਹਨਾਂ ਨੂੰ ਉਹਨਾਂ ਦੇ ਬੋਲ ਮਾਰਦੇ ਹੈਗੇ ਜੇ ਉਹ ਵੱਜੇ ਤਾਂ ਉਹ ਆਊਟ ਹੋ ਜਾਂਦੇ ਨੇ ਅਤੇ ਬਰਫ ਪਾਣੀ ਬਰਫ ਪਾਣੀ ਦੇ ਵਿੱਚ ਇੱਕ ਦਾਵੀ ਦਿੰਦਾ ਬਾਕੀ ਸਾਰੇ ਭੱਜਦੇ ਆ ਅਤੇ ਜਿਹੜਾ ਜਿਹੜਾ ਫੜਿਆ ਜਾਵੇ ਅਤੇ ਉਹਨੂੰ ਬਰਫ ਕੀਤਾ ਜਾਂਦਾ ਅਤੇ ਜੇ ਬਾਕੀ ਉਹਨੂੰ ਉਹ ਕਰ ਦੇਣ ਹੱਥ ਲਾ ਜਾਣ ਤਾਂ ਉਹ ਪਾਣੀ ਹੋ ਜਾਂਦਾ ਹੈਗਾ ਅਤੇ ਇਵੇਂ ਇਸੇ ਤਰ੍ਹਾਂ ਹੀ ਫੜਨ ਮੀਚੀ ਖੇਡਿਆਂ ਜਾਂਦਾ ਹੈ ਇੱਕ ਜਾਣਾ ਫੜਦਾ ਹੈਗਾ ਜਿਹੜਾ ਫੜਿਆ ਜਾਵੇ ਫਿਰ ਨਾਲ ਦੂਜਾ ਉਹਨਾਂ ਦੀ ਹੈਲਪ ਕਰਾਉਂਦਾ ਅਤੇ ਉਹ ਵੀ ਨਾਲ ਹੀ ਮਤਲਬ ਕਿ ਉਹਦੇ ਨਾਲ ਫੜਾਉਂਦਾ ਹੈਗਾ ਇਹ ਇਸ ਤਰ੍ਹਾਂ ਪੰਜਾਬ ਵਿੱਚ ਬਹੁਤ ਹੀ ਜ਼ਿਆਦਾ ਖੇਡਾਂ ਖੇਡੀਆਂ ਜਾਂਦੀਆਂ ਨੇ